ਕੁਝ ਛੋਟੀ ਗਤੀਵਿਧੀਆਂ ਹਨ ਜੋ ਕਿ ਮੈਨੂੰ ਸਿਹਤਮੰਦ ਰੱਖਣ ਵਿੱਚ ਮਦਦਗਾਰ ਹੁੰਦੀਆਂ ਹਨ ਇਹਨਾਂ ਵਿੱਚ ਗੱਲ ਕਰੀਏ ਤਾਂ ਦੌੜਨਾ ਜਾਂ ਜੋਗਿੰਗ ਕਰਨਾ ਆ ਜਾਂਦਾ ਹੈ ਇਹਦੇ ਵਿੱਚ ਕੀ ਆ ਸਾਨੂੰ ਫਿਟ ਰੱਖਣ ਵਿੱਚ ਮਦਦਗਾਰ ਹੁੰਦੇ ਹਨ ਸਾਡੇ ਦਿਲ ਸਿਸਟਮ ਨੂੰ ਸਹੂਲਤ ਪ੍ਰਦਾਨ ਕਰਦੀਆਂ ਹਨ ਹਾਕਿੰਗ ਜਾਂ ਚਲਣਾ ਵੀ ਹੁੰਦਾ ਇੱਕ ਹਿਸਾਬ ਦੀ ਇਹ ਕੀ ਹੁੰਦਾ ਕਿ ਸਾਡੇ ਸਰੀਰ ਨੂੰ ਸਥਿਰ ਰੱਖਣ ਅਤੇ ਜਿਹੜੇ ਪ੍ਰਵੇਸ਼ ਦੇ ਮੇਲੇ ਇਸ ਤਰ੍ਹਾਂ ਅਨ ਲਈ ਅਨ ਅਮੋਲ ਹੁੰਦਾ ਹੈ ਚੌਥਾ ਤੀਜਾ ਮੇਰੇ ਫੇਮ ਬਹੁਤ ਪ੍ਰਸਿੱਧ ਹੈ ਕਿ ਸਵਿਮਿੰਗ ਕਰਨਾ ਸਵਿਮਿੰਗ ਕਰਨ ਵਿੱਚ ਕੀ ਹੁੰਦਾ ਹੈ ਕਿ ਸਾਡੀ ਸਮੂਹ ਬਾਡੀ ਜਿਹੜੀ ਹੁੰਦੀ ਨੇ ਪੂਰੀ ਬਾਡੀ ਇਸਦੇ ਸਾਰੇ ਹਿੱਸਿਆਂ ਨੂੰ ਨਾ ਵਰਤਣ ਦੇ ਲਈ ਸਹੂਲਤ ਪ੍ਰਦਾਨ ਕਰਦਾ ਇਸ ਨਾਲ ਕੀ ਹੁੰਦਾ ਕਿ ਸਾਡੀ ਤੰਦਰੁਸਤੀ ਵੀ ਵੱਧ ਜਾਂਦੀ ਹੈ ਇਹ ਕੁਝ ਗਤੀਵਿਧੀਆਂ ਨਾਲ ਨਾ ਸਾਡਾ ਸਰੀਰ ਅਤੇ ਸਾਡਾ ਮਾਨਸਿਕ ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਸਾਨੂੰ ਇਹਨਾਂ ਨੂੰ ਆਪਣੇ ਦਿਨਚਰੀਆ ਵਿੱਚ ਸ਼ਾਮਿਲ ਕਰਕੇ ਆਪਣੇ ਆਪ ਨੂੰ ਤਾਂ ਸਿਹਤਮੰਦ ਅਤੇ ਤੰਦਰੁਸਤ ਰੱਖਣਾ ਚਾਹੀਦਾ ਧੰਨਵਾਦ